ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਕੁਲਵਿੰਦਰ ਕੌਰ ਗੁਰਦਾਸਪੁਰ ਸ਼ਹਿਰ ਤੋਂ ਬੋਲ ਰਹੀ ਹਾਂ ਔਰ ਮੈਂ ਸਿਲਾਈ ਦਾ ਕੰਮ ਕਰਦੀ ਹਾਂ ਸ਼ੁਰੂ ਸ਼ੁਰੂ ਜਦੋਂ ਮੈਂ ਸਿਲਾਈ ਦਾ ਕੰਮ ਸ਼ੁਰੂ ਕੀਤਾ ਸੀ ਬੁਟੀਕ ਦਾ ਕੰਮ ਉਹਦੇ ਵਿੱਚ ਇੱਕ ਸ਼ੁਰੂ ਸ਼ੁਰੂ ਵਿੱਚ ਮੈਨੂੰ ਕੋਈ ਕੋਈ ਮੁਸ਼ਕਲ ਆਈ ਸੀ ਔਰ ਫਿਰ ਮੈਂ ਜਦੋਂ ਯੂਟਿਊਬ ਦਾ ਸਹਾਰਾ ਲਿਆ ਤਾਂ ਉਹਦੇ ਵਿੱਚ ਮੈਨੂੰ ਸਾਰਾ ਉਨ੍ਹਾਂ ਨੇ ਦੱਸਿਆ ਵੀ ਇਹਨੂੰ ਇਸ ਤਰ੍ਹਾਂ ਠੀਕ ਕਰਨਾ ਚਾਹੀਦਾ ਹੈ ਇਹਨੂੰ ਇਸ ਤਰ੍ਹਾਂ ਠੀਕ ਕਰਨਾ ਚਾਹੀਦਾ ਹੈ ਉਹਦੇ ਨਾਲ ਮੇਰੀ ਨੌਲੇਜ ਹੋਰ ਜ਼ਿਆਦਾ ਵੱਧ ਗਈ ਔਰ ਮੇਰੀਆਂ ਮੁਸ਼ਕਲਾਂ ਜਿਹੜੀਆਂ ਸਾਰੀਆਂ ਹੱਲ ਹੁੰਦੀਆਂ ਗਈਆਂ ਹੁਣ ਕਦੀ ਵੀ ਇਸ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਈ ਕਿ ਜਿੱਦਾਂ ਕੁਛ ਖਰਾਬ ਹੋ ਸਕੇ ਔਰ ਸਾਰੇ ਕਸਟਮਰ ਬਹੁਤ ਜ਼ਿਆਦਾ ਖੁਸ਼ ਹੁੰਦੇ ਹੈ ਕਿ ਇੰਨਾ ਵਧੀਆ ਬਣਦਾ ਆ ਔਰ ਬਹੁਤ ਵਧੀਆ ਚਲਦਾ ਪਿਆ ਕੰਮ ਔਰ ਮੈਂ ਉਮੀਦ ਕਰਦੀ ਹਾਂ ਕਿ ਇੱਕ ਵੱਲ ਦੇਖ ਕੇ ਹੋਰ ਵੀ ਜ਼ਿਆਦਾ ਕਸਟਮਰਸ ਮਤਲਬ ਆਉਣ ਇਹਦੇ ਨਾਲ ਨਾਲ ਮੈਂ ਇੱਕ ਸੂਟ ਵਗੈਰਾ ਵੀ ਰੱਖੇ ਹੋਏ ਹੈ ਉਹ ਵੀ ਲੋਕ ਇੱਥੋਂ ਲੈ ਕੇ ਫਿਰ ਇੱਥੋਂ ਹੀ ਸਿਲਵਾ ਲੈਂਦੇ ਹੈ ਔਰ ਖੁਸ਼ ਹੁੰਦੇ ਸਾਰੇ ਕਸਟਮਰ ਓਕੇ ਜੀ ਧੰਨਵਾਦ ਬਾ